ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਹਾਂ ਹਾਂਜੀ ਮੈਮ ਮੈਂ ਆਊਟ ਔਫ ਸਿਟੀ ਸੀ ਤਾਂ ਮੈ ਫੀਸ ਪੇਮੈਂਟ ਨਹੀਂ ਕੀਤੀ ਤੇ ਮੈਂ ਤੁਸੀਂ ਮੈਨੂੰ ਅ ਕਿਯੂ ਆਰ ਕੋਡ ਸੈਂਡ ਕਰ ਦਿਓ ਅਤੇ ਮੈਂ ਤੁਹਾਨੂੰ ਪੇਮੈਂਟ ਕਰ ਦਿੰਦੀ ਹਾਂ ਹਾਂ ਅਕਾਊਂਟ ਨੰਬਰ ਸੈਂਡ ਕਰ ਦਿਓ ਅਤੇ ਕਿਯੂ ਆਰ ਤੋਂ ਕੋਡ ਸੈਂਡ ਕਰ ਦਿਓ ਮੈਂ ਦੋਨਾਂ ਦੀ ਪੇਮੈਂਟ ਕਰ ਦਾਂਗੀ ਹੋਰ ਹਾਂ ਹਾਂਜੀ ਮੈਮ ਹਾਂਜੀ ਹਾਂਜੀ ਹਾਂ ਮੈਮ ਕਿਵੇਂ ਹਾਂ ਕਿੰਨੀ ਫੀਸ ਹੈ ਜੀ ਇੱਕ ਹਜ਼ਾਰ ਠੀਕ ਹੈ ਮੈਮ ਮੈਨੂੰ ਜਾਂ ਕਿਯੂ ਆਰ ਕੋਡ ਸੈਂਡ ਕਰ ਦਿਓ ਜਾਂ ਅਕਾਊਂਟ ਨੰਬਰ ਦੇ ਦਿਓ ਮੈਂ ਉੱਥੇ ਸੈਂਡ ਕਰ ਦਾਂਗੀ ਔਰ ਰਾਹੁਲ ਦੀ ਪਰਫੋਰਮੈਂਸ ਕਿੱਦਾਂ ਚੱਲਦੀ ਪਈ ਆ ਵਧੀਆ ਚਲਦੀ ਪਈ ਆ ਹਾਂ ਠੀਕ ਹੈ ਮੈਮ ਮੈਂ ਤੁਹਾਨੂੰ ਸੈਂਡ ਕਰ ਦਿੰਦੀ ਹਾਂ